ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਭਾਅ ਜੀ ਮੈਂ ਰਮਨਦੀਪ ਬੋਲਦਾ ਪਿਆ ਹਾਂ ਗੁਰਦਾਸਪੁਰ ਤੋਂ ਕੱਲ੍ਹ ਭਾਅ ਜੀ ਮੈਂ ਸ਼ਾਮ ਨੂੰ ਤੁਹਾਡੀ ਐਪ ਉਬਰ ਐਪ 'ਤੇ ਮੈਂ ਬੁਕਿੰਗ ਕਰਵਾਈ ਸੀਗੀ ਤੁਹਾਡੀ ਕੈਬ ਦੀ ਤੁਸੀਂ ਕੱਲ੍ਹ ਅੰਮ੍ਰਿਤਸਰ ਜਾਣਾ ਵਾ ਨਾ ਸ਼ਾਮ ਨੂੰ ਛੇ ਵਜੇ ਓਹ ਪੇਪਰ ਸੀਗਾ ਭਾਅ ਜੀ ਮੇਰਾ ਵੀ ਪੇਪਰ ਹੈਗਾ ਵਾ ਜਿੱਦਾਂ ਤੁਹਾਡਾ ਪੇਪਰ ਆ ਅਤੇ ਮੈਂ ਤੁਹਾਨੂੰ ਕਹਿਣਾ ਸੀਗਾ ਵੀ ਮੈਨੂੰ ਓਦਾਂ ਮੈਂ ਕੱਲ੍ਹ ਬੱਸ ਸਟੈਂਡ ਉਤਰਨਾ ਸੀਗਾ ਇੱਥੋਂ ਗੁਰਦਾਸਪੁਰ ਤੋਂ ਜਾ ਕੇ ਬੱਸ ਤੋਂ ਉੱਥੋਂ ਅਤੇ ਮੈਂ ਹੁਣ ਬਸ 'ਤੇ ਨਹੀਂ ਆ ਰਿਹਾ ਮੈਂ ਐਕਚੁਲੀ ਅੱਗੋਂ ਟ੍ਰੇਨ 'ਤੇ ਆ ਰਿਹਾ ਹਾਂ ਅਤੇ ਮੈਂ ਤੁਹਾਨੂੰ ਇਹੀ ਦੱਸਣਾ ਸੀਗਾ ਵੀ ਤੁਸੀਂ ਮੈਨੂੰ ਅੱਗੇ ਜਿਹੜਾ ਵਾ ਉਹ ਬਸ ਸਟੈਂਡ ਦੀ ਜਗ੍ਹਾ ਸਟੇਸ਼ਨ 'ਤੇ ਆ ਜਾਇਓ ਤੁਸੀਂ ਲੈਣ ਕਿਉਂਕਿ ਗੱਲ ਪਤਾ ਕੀ ਆ ਅਸਲ ਵਿੱਚ ਮੈਂ ਸੋਚਦਾ ਪਿਆ ਸੀ ਵੀ ਜੇ ਸਟੇਸ਼ਨ 'ਤੇ ਆਜੋਗੇ ਤੁਸੀਂ ਅਤੇ ਉੱਥੋਂ ਮੈਨੂੰ ਸਗੋਂ ਥੋੜ੍ਹਾ ਨੇੜੇ ਪਏਗਾ ਅਤੇ ਨਾਲੇ ਇਹ ਆ ਮੈਂ ਵੀ ਸਗੋਂ ਉੱਥੋਂ ਟਾਈਮ 'ਤੇ ਪਹੁੰਚਾਂਗਾ ਨਾਲੇ ਤੁਸੀਂ ਤੁਹਾਨੂੰ ਵੀ ਉੱਥੋਂ ਸਗੋਂ ਪਿਕ ਕਰਨਾ ਥੋੜ੍ਹਾ ਈਜ਼ੀ ਹੋ ਜਾਏਗਾ ਥੋੜ੍ਹਾ ਜਿਹਾ ਦੇਖ ਲਿਓ ਤੁਸੀਂ ਜੇ ਉੱਧਰ ਨੂੰ ਆ ਜਾਓਗੇ ਥੋੜ੍ਹਾ ਜਿਹਾ ਮੈਂ ਇੱਧਰ ਨੂੰ ਹੋ ਜਾਵਾਂਗਾ ਥੋੜ੍ਹਾ ਜਿਹਾ ਤੁਸੀਂ ਉੱਧਰ ਨੂੰ ਆ ਜਾਇਓ ਅਤੇ ਰਲਦਾ ਮਿਲਦਾ ਜਿੱਥੇ ਕਿ ਜਿਹੇ ਹੋ ਜਾਵਾਂਗੇ ਅਤੇ ਬਾਕੀ ਫੋਨ ਕਰ ਲਿਓ ਤੁਸੀਂ ਆਪਾਂ ਅਤੇ ਮੀਟ ਅੱਪ ਕਰ ਲਵਾਂਗੇ ਅਸੀਂ ਅਤੇ ਬਾਕੀ ਲੇਟ ਨਾ ਕਰਿਓ ਥੋੜ੍ਹਾ ਜਿਹਾ ਟਾਈਮ 'ਤੇ ਰੱਖਿਓ ਆਪਣਾ ਪੂਰਾ ਸ਼ਡਿਊਲ ਕਿਉਂਕਿ ਆਪਾਂ ਮਿਹਨਤ ਕੀਤੀ ਆ ਬੜੇ ਸਾਲ ਹੋ ਗਿਆ ਮਿਹਨਤ ਕਰਦਿਆਂ ਕਰਦਿਆਂ ਅਤੇ ਹੁਣ ਪੇਪਰ ਵਾ ਅਤੇ ਪੂਰਾ ਟਾਈਮ 'ਤੇ ਪਹੁੰਚਣਾ ਵਾ ਅਤੇ ਇਸ ਕਰਕੇ ਲੇਟ ਨਾ ਕੀਤਾ ਜਾਏ ਠੀਕ ਆ ਨਾ ਕੋਸ਼ਿਸ਼ ਕਰਿਓ ਵੀ ਪੂਰਾ ਟਾਈਮ 'ਤੇ ਪਹੁੰਚੀਏ ਅਤੇ ਬਾਕੀ ਤੁਸੀਂ ਫੋਨ ਕਰ ਲਿਓ ਇੱਕ ਵਾਰੀ ਸਵੇਰੇ ਮੈਨੂੰ ਜਰਾ ਟਾਈਮ 'ਤੇ ਜਰਾ ਅਤੇ ਮੈਂ ਵੀ ਤੁਹਾਨੂੰ ਕਾਲ ਬੈਕ ਕਰਦਾਂਗਾ ਠੀਕ ਹੈ ਥੈਂਕ ਯੂ ਭਾਅ ਜੀ